ਮੇਰੀ ਰਸੋਈ ਵਿੱਚ ਗੈਸ ਚੁੱਲਾ ਮਾਈਕ੍ਰੋਵੇਵ ਮਿਕਸਰ ਗਰਾਈਂਡਰ ਅਤੇ ਮਾਈਕਰੋਵੇਵ ਅਤੇ ਓਵਨ ਹੈ ਅਤੇ ਗੈਸ ਹੈ ਜਦੋਂ ਵੀ ਮੈਂ ਕੋਈ ਚੀਜ਼ ਗਰਮ ਕਰਨੀ ਹੁੰਦੀ ਹੈ ਤਾਂ ਮੈਂ ਗੈਸ ਮਾਈਕਰੋਵੇਵ ਤੇ ਗਰਮ ਕਰ ਲੈਂਦੀ ਹਾਂ ਪੁਰਾਣੇ ਜ਼ਮਾਨੇ 'ਚ ਅਸੀਂ ਮਸਾਲਾ ਵਗੈਰਾ ਪੀਸਣ ਵਾਸਤੇ ਸਿਲਵੱਟਾ ਅਤੇ ਦੋਰੀ ਡੰਡੇ ਦਾ ਯੂਜ ਕਰਦੇ ਸਨ ਲੇਕਿਨ ਹੁਣ ਸਾਨੂੰ ਮਸਾਲਾ ਪੀਸਣ ਵਾਸਤੇ ਮਿਕਸਚਰ ਗਰਾਇੰਡਰ ਹਨ ਪਹਿਲਾਂ ਅਸੀਂ ਕੋਈ ਵੀ ਚੀਜ਼ ਗਰਮ ਕਰਨੀ ਹੁੰਦੀ ਸੀਗੀ ਤਾਂ ਸਾਨੂੰ ਚੁੱਲਾ ਬਾਲਣਾ ਪੈਂਦਾ ਸੀਗਾ ਲੇਕਿਨ ਹੁਣ ਸਾਡੇ ਕੋਲ ਮਾਈਕਰੋਵੇਵ ਹੈ ਅਸੀਂ ਮਾਈਕਰੋਵੇਟ ਤੇ ਗਰਮ ਕਰ ਲੈਂਦੇ ਹਨ ਪਹਿਲਾਂ ਪਾਣੀ ਨਹਾਉਣ ਵਾਸਤੇ ਪਾਣੀ ਗਰਮ ਕਰਨ ਲਈ ਅਸੀਂ ਚੁੱਲੇ ਬਾਲਦੇ ਸਨ ਲੇਕਿਨ ਹੁਣ ਸਾਡੇ ਕੋਲ ਗੀਜ਼ਰ ਹਨ ਅਤੇ ਅਸੀਂ ਗੀਜ਼ਰ ਦਾ ਯੂਜ ਕਰਦੇ ਹਨ ਪਹਿਲਾਂ ਅਸੀਂ ਕੋਈ ਵੀ ਚੀਜ਼ ਚੁੱਲੇ ਤੇ ਭੁੰਨਦੇ ਸਨ ਲੇਕਿਨ ਹੁਣ ਸਾਡੇ ਕਿਚਨ ਵਿੱਚ ਏਅਰ ਫਰਾਇਅਰ ਹਨ ਅਤੇ ਅਸੀਂ ਏਅਰ ਫਰਾਇਅਰ 'ਚ ਉਹ ਚੀਜ਼ ਬਣਾ ਲੈਂਦੇ ਹਨ ਅਤੇ ਪਹਿਲਾਂ ਸ ਪਹਿਲੇ ਜ਼ਮਾਨੇ ਵਿੱਚ ਅਸੀਂ ਕੁਛ ਵੀ ਮਸਾਲਾ ਵਗੈਰਾ ਪੀਸਣਾ ਹੁੰਦਾ ਸੀਗਾ ਜਾਂ ਕੁਛ ਕੱਦੂਕਸ ਕਰਨਾ ਹੁੰਦਾ ਸੀਗਾ ਤਾਂ ਅਸੀਂ ਕੱਦੂਕਸ ਰਾਹੀਂ ਕੱਦੂਕਸ ਕਰਦੇ ਸਨ ਲੇਕਿਨ ਹੁਣ ਅਸੀਂ ਚੌਪਰ ਨਾਲ ਹਰ ਚੀਜ਼ ਚੋਪ ਕਰ ਲੈਂਦੇ ਹਨ ਅਤੇ ਚੌਪਰ ਨਾਲ ਚੋਪ ਕਰਨ ਨਾਲ ਅਸੀਂ ਓ ਉਸ ਕੰਮ ਨੂੰ ਆਸਾਨ ਬਣਾ ਲੈਂਦੇ ਹਨ ਅਤੇ ਪਹਿਲਾਂ ਅਸੀਂ ਕੋਈ ਵੀ ਸਬਜ਼ੀ ਵਗੈਰਾ ਗਰਮ ਕਰਨੀ ਹੁੰਦੀ ਸੀਗੀ ਤਾਂ ਅਸੀਂ ਚੁੱਲਾ ਬਾਲਦੇ ਸਨ ਹੁਣ ਸਾਨੂੰ ਚੁੱਲਾ ਬਾਲਣ ਦੀ ਲੋੜ ਨਹੀਂ ਪੈਂਦੀ ਅਸੀਂ ਗੈਸ ਮਾਈਕਰੋਵੇਵ 'ਚ ਗਰਮ ਕਰ ਲੈਂਦੇ ਹਾਂ